ਮੈਂ ਹਿੰਦੂ ਧਰਮ ਨੂੰ ਮੰਨਦੀ ਹਾਂ ਅਤੇ ਹਿੰਦੂ ਧਰਮ ਸਿਖਾਉਂਦਾ ਹੈ ਕਿ ਸਾਰੇ ਧਰਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਹਿੰਦੂ ਧਰਮ ਸਿਖਾਉਂਦਾ ਹੈ ਕਿ ਲੋਕਾਂ ਦੀ ਮਦਦ ਕਰਨਾ ਬਹੁਤ ਹੀ ਲਾਭਦਾਇਕ ਹੁੰਦਾ ਹੈ ਲੋਕਾਂ ਦੀ ਮਦਦ ਕਰਨਾ ਅਤੇ ਉਹਨਾਂ ਦੀ ਸੇਵਾ ਕਰਨਾ ਬਹੁਤ ਹੀ ਚੰਗੀ ਗੱਲ ਹੁੰਦੀ ਹੈ ਲੋਕਾਂ ਦੀ ਸੇਵਾ ਕਰਨਾ ਜਿਵੇਂ ਕਿ ਜ਼ਰੂਰਤਮੰਦਾ ਨੂੰ ਭੋਜਨ ਖਿਲਾਉਣਾ ਆਦਿ ਅਤੇ ਮੈਂ ਇਹ ਚਾਹੁੰਗੀ ਕਿ ਮੈਂ ਹਮੇਸ਼ਾਂ ਲੋਕਾਂ ਦੀ ਸਹਾਇਤਾ ਕਰਾਂ ਅਤੇ ਆਪਣੇ ਹਿੰਦੂ ਧਰਮ ਦੇ ਨਾਲ ਨਾਲ ਹੋਰ ਧਰਮਾਂ ਦੀ ਵੀ ਰਿਸਪੈਕਟ ਕਰਾਂ ਅਤੇ ਉਨ੍ਹਾਂ ਨੂੰ ਸਨਮਾਨ ਦੇਵਾਂ